ਸਾਡੇ ਘਰ ਵਿੱਚ ਖਾਣਾ ਬਣਾਉਣ ਸਮੇਂ ਅਲੱਗ ਅਲੱਗ ਤਰ੍ਹਾਂ ਦੇ ਮਸਾਲੇ ਯੂਜ਼ ਹੁੰਦੇ ਹਨ ਖਾਣਾ ਬਣਾਉਣ ਲਈ ਅਲੱਗ ਅਲੱਗ ਤਰ੍ਹਾਂ ਦੇ ਮਸਾਲੇ ਯੂਜ਼ ਹੋਣ ਦੇ ਨਾਲ ਧਨੀਆ ਪਾਊਡਰ ਗਰਮ ਮਸਾਲਾ ਛੋਲਿਆਂ ਦਾ ਮਸਾਲਾ ਰੈਡ ਮਸਾਲੇ ਹਰੇਕ ਤਰ੍ਹਾਂ ਦੇ ਗਰਮ ਮਸਾਲਾ ਚਿਲੀ ਮਸਾਲਾ ਹਰੇਕ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਹੁੰਦੀ ਹੈ ਇਸੇ ਤਰ੍ਹਾਂ ਜੇ ਆਪਾਂ ਫਰੂਟ ਖਾਣਾ ਹੈ ਉਸ ਦੇ ਉੱਤੇ ਕੱਟ ਕੇ ਇੱਕ ਫਰੂਟ ਚਾਟ ਦੀ ਤਰ੍ਹਾਂ ਮਸਾਲਾ ਹੁੰਦਾ ਹੈ ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਇਸੇ ਤਰ੍ਹਾਂ ਜੇ ਐਸ ਮੈਂ ਆਪਣੇ ਘਰ ਦੀ ਗੱਲ ਕਰਾਂ ਤਾਂ ਸਾਡੇ ਘਰ ਵਿੱਚ ਦਾਲਚੀਨੀ ਦਾ ਮਸਾਲਾ ਲੈਚੀਆਂ ਦਾ ਮਸਾਲਾ ਲੌਂਗ ਦਾ ਮਸਾਲਾ ਵੱਡ ਵੱਡੇ ਮਸਾਲੇ ਸੌਂਫ ਦਾ ਮਸਾਲਾ ਇਹਨਾਂ ਨੂੰ ਰਗੜ ਕੇ ਇੱਕ ਮਸਾਲਾ ਤਿਆਰ ਕੀਤਾ ਜਾਂਦਾ ਹੈ ਜਿਸਦੀ ਚਾਹ ਬਹੁਤ ਹੀ ਵਧੀਆ ਤਰੀਕੇ ਨਾਲ ਬਣਦੀ ਹੈ ਇਸੇ ਤਰ੍ਹਾਂ ਖੰਡ ਸਾਡੇ ਘਰ ਵਿੱਚ ਬਣਨ ਵਾਲੇ ਪਕਵਾਨਾਂ ਵਿੱਚੋਂ ਖੰਡ ਇੱਕ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਚਾਹ ਦੇ ਵਿੱਚ ਅਸੀਂ ਖੰਡ ਯੂਜ਼ ਕਰਦੇ ਹਾਂ ਜਦੋਂ ਕੋਈ ਚੂਰੀ ਕੁੱਟਦੇ ਹਾਂ ਤਾਂ ਅਸੀਂ ਗੁੜ ਯੂਜ਼ ਕਰ ਸਕਦੇ ਹਾਂ ਵੈਸੇ ਅਸੀਂ ਖਾਣ ਦੇ ਲਈ ਖੰਡ ਅਤੇ ਘਿਓ ਰਲ਼ਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਰੋਟੀ ਤੋਂ ਬਾਅਦ ਅਸੀਂ ਖਾਂਦੇ ਇਸ ਤਰ੍ਹਾਂ ਖੰਡ ਅਤੇ ਮਸਾਲੇ ਬਹੁਤ ਹੀ ਜ਼ਰੂਰੀ ਘਰੇਲੂ ਰਸੋਈ ਵਿੱਚ ਬਹੁਤ ਹੀ ਲੋਂੜੀਦੀਆਂ ਦੋ ਅਜਿਹੀਆਂ ਚੀਜ਼ਾਂ ਨੇ ਜਿਹਨਾਂ ਬਿਨਾਂ ਰਸੋਈ ਅਧੂਰੀ ਹੈ